ਪ੍ਰੈੱਸ ਦੀ ਅਜ਼ਾਦੀ ਬਾਰੇ ਸਾਡੇ ਵਿਚਾਰ ਇਹ ਹਨ ਕਿ ਪ੍ਰੈੱਸ ਜਿਹੜਾ ਹੈ ਪੂਰਨ ਤੌਰ 'ਤੇ ਅਜ਼ਾਦ ਨਹੀਂ ਹੈ ਸਮੇਂ ਦੀ ਜਿਹੜੀ ਕੋਈ ਸਰਕਾਰ ਹੁੰਦੀ ਹੈ ਇਹਨਾਂ 'ਤੇ ਆਪਦੀ ਪਾਬੰਦੀ ਲਾ ਦਿੰਦੀ ਹੈ ਅਤੇ ਜੋ ਕੋਈ ਸਹੀ ਆਵਾਜ਼ ਕੱਢਦਾ ਜਾਂ ਸਹੀ ਖਬਰਾਂ ਭੇਜਦਾ ਉਹਦੇ ਸੈਂਸਰ ਲਾਇਆ ਜਾਂਦਾ ਅਤੇ ਜੋ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਚੈਨਲ ਬਣਾਏ ਨੇਗੇ ਉਹਨਾਂ ਨੂੰ ਜ਼ਿਆਦਾ ਖੁਦਮੁਖਤਾਰੀ ਦਿੱਤੀ ਜਾਂਦੀ ਹੈ ਅਤੇ ਉਹ ਜੋ ਸਰਕਾਰਾਂ ਕਹਾਉਣਾ ਚਾਹੁੰਦੀਆਂ ਨੇ ਉਹੀ ਕਰਦੇ ਨਗੇ ਇਹਨਾਂ ਦੇ ਵਿੱਚ ਸਾਰਾ ਸਰਕਾਰਾਂ ਦਾ ਹੱਥ ਹੁੰਦਾ ਆਪਣੀਆਂ ਗੱਲਾਂ ਨੂੰ ਵੱਧ ਚੜ੍ਹ ਕੇ ਦਰਸਾਉਂਦੇ ਨਗੇ ਅਤੇ ਲੋਕਾਂ ਨੂੰ ਗੁੰਮਰਾਹ ਕਰ ਦੇਣਗੇ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਪੂਰਨ ਆਜ਼ਾਦੀ ਚਾਹੀਦੀ ਆ ਜੇ ਪ੍ਰੈੱਸ ਦੀ ਹੋਵੇ ਤਾਂ ਸਹੀ ਖਬਰਾਂ ਮਿਲ ਸਕਦੀਆਂ ਨਗੀਆ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕਦਾ ਧੰਨਵਾਦ